ਆਧੁਨਿਕ ਸਮਾਜ ਅਣਗਿਣਤ ਸਮੂਹਾਂ ਦੀਆਂ ਸਰੰਚਨਾਵਾਂ ਅਤੇ ਅੰਤਰ ਕਿਰਿਆਵਾਂ ਦਾ ਜਾਲ ਬਣ ਗਏ ਹਨ ਅੱਜ ਸਮੂਹਾਂ ਦੇ ਮਾਧਿਅਮ ਰਾਹੀਂ ਨਾ ਕੇਵਲ ਵਿਅਕਤੀ ਦੀਆਂ ਸਾਰੀਆਂ ਗਤੀਵਿਧੀਆਂ ਸੰਪਾਦਿਤ ਹੁੰਦੀਆਂ ਹਨ ਬਲਕਿ ਇਹਨਾਂ ਦੀਆਂ ਸੀਮਾਵਾਂ ਵੀ ਨਿਰਧਾਰਿਤ ਹੋਣ ਲੱਗੀਆਂ ਹਨ ਹਰੇਕ ਸਮਾਜ ਵਿੱਚ ਰਾਜਨੀਤੀ ਅਤੇ ਸਰਕਾਰਾਂ ਸਮੂਹਾਂ ਦੀਆਂ ਅੰਦਰੂਨੀ ਵਿਵਸਥਾ ਨਾਲ ਹੀ ਜੁੜਦੀਆਂ ਜਾ ਰਹੀਆਂ ਹਨ ਸਮੂਹਾਂ ਦੀਆਂ ਮੰਗਾਂ ਅਤੇ ਸਮਰਥਨਾਂ 'ਤੇ ਹੀ ਸਰਕਾਰ ਦੇ ਕਾਰਜ ਪ੍ਰਣਾਲੀ ਨਿਰਭਰ ਕਰਨ ਲੱਗੀ ਹੈ ਵਿਅਕਤੀ ਦੇ ਜੀਵਨ ਦਾ ਹਰੇਕ ਪਹਿਲੂ ਕਿਸੇ ਨਾ ਕਿਸੇ ਤਰ੍ਹਾਂ ਦੇ ਸੰਗਠਿਤ ਜਾ ਅਸੰਗਠਿਤ ਸਮੂਹਾਂ ਨਾਲ ਸੰਬੰਧਿਤ ਹੋ ਗਿਆ ਹੈ ਇਸ ਲਈ ਅੱਜ ਦੇ ਬਦਲੇ ਹੋਏ ਅਤੇ ਜਟਿਲ ਸਮਾਜ ਵਿੱਚ ਰਾਜਨੀਤਿਕ ਦਲ ਸਰਕਾਰ ਅਤੇ ਜਨਤਾ ਵਿੱਚਕਾਰ ਸੰਪਰਕ ਦਾ ਸਿੱਧਾ ਸਾਧਣ ਨਹੀਂ ਰਹਿ ਗਏ ਬਲਕਿ ਸਮਾਜ ਦੇ ਸਮੂਹ ਦੇ ਮਾਧਿਅਮ ਰਾਹੀਂ ਕਿਰਿਆਸ਼ੀਲ ਹੋਣ ਲੱਗ ਪਏ ਹਨ ਇਹੋ ਕਾਰਨ ਹੈ ਕਿ ਆਧੁਨਿਕ ਸਮਾਜ ਵਿੱਚ ਦਬਾਓ ਸਮੂਹਾਂ ਅਤੇ ਹਿੱਤ ਸਮੂਹਾਂ ਦੀ ਵਿਸ਼ੇਸ਼ ਮਹੱਤਤਾ ਬਣ ਗਈ ਹੈ ਹੁਣ ਰਾਜਨੀਤੀ ਨੂੰ ਸਿਰਫ ਰਾਜ ਅਤੇ ਸ਼ਾਸਨ ਦਾ ਵਿਗਿਆਨ ਨਹੀਂ ਮੰਨਿਆ ਜਾਂਦਾ ਸਗੋਂ ਇਸ ਵਿੱਚ ਨਿਰਣੇ ਲੈਣ ਦੀ ਪ੍ਰਕਿਰਿਆ ਦਾ ਅਧਿਐਨ ਵੀ ਸ਼ਾਮਿਲ ਕੀਤਾ ਜਾਣ ਲੱਗ ਪਿਆ ਹੈ ਕਈ ਵਿਦਵਾਨ ਹਿੱਤ ਸਮੂਹ ਅਤੇ ਦਬਾਓ ਸਮੂਹ ਵਿੱਚ ਕੋਈ ਅੰਤਰ ਨਹੀਂ ਕਰਦੇ ਹਿੱਤ ਸਮੂਹ ਅਤੇ ਦਬਾਅ ਸਮੂਹਾਂ ਵਿੱਚ ਬਹੁਤ ਕੁਝ ਇੱਕਸਾਰਤਾ ਮੌਜੂਦ ਹੋਣ ਕਰਕੇ ਇਹਨਾਂ ਨੂੰ ਇੱਕ ਹੀ ਮੰਨ ਲੈਣ ਦੀ ਗਲਤੀ ਕਰਨਾ ਸੁਭਾਵਿਕ ਹੈ ਕਿਉਂਕਿ ਦੋਨਾਂ ਦੇ ਸਪਸ਼ਟ ਅਤੇ ਵਿਸ਼ੇਸ਼ ਉਦੇਸ਼ ਹੁੰਦੇ ਹਨ ਅਤੇ ਦੋਨਾਂ ਨੂੰ ਹੀ ਆਪਣੇ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਯਤਨਸ਼ੀਲ ਰਹਿੰਦੇ ਹਨ